ਹੈਲੋ ਤੁਹਾਡਾ ਗੁਰੂ ਨਾਨਕ ਟਰੈਵਲ ਗਾਈਡ 'ਚ ਤੁਹਾਡਾ ਬਹੁਤ ਹੀ ਬਹੁਤ ਸਵਾਗਤ ਹੈ ਅੱਜ ਸਾਨੂੰ ਕਿਵੇਂ ਯਾਦ ਕੀਤਾ ਸਾਨੂੰ ਠੀਕ ਹੈ ਤੁਸੀਂ ਟੂਰ 'ਤੇ ਕਿੱਥੇ ਕਿਸ ਸਾਈਡ ਵੱਲ ਜਾਣਾ ਚਾਹੁੰਦੇ ਹੋ ਤੁਸੀਂ ਬਾਏ ਮਾਊਂਟੇਨ ਏਰੀਆ ਦੀ ਸੈਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟੂਰ 'ਚ ਹਿੱਲੀ ਏਰੀਆ ਜਾਂ ਫਿਰ ਤੁਸੀਂ ਸ਼ਹਿਰ ਦੇ ਵਿੱਚ ਕੋਈ ਟੂਰ ਕੱਢਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਆਊਟ ਔਫ ਸਟੇਟ ਜਾਣਾ ਚਾਹੁੰਦੇ ਹੋ ਜਾਂ ਕੋਈ ਤਖ਼ਤ ਕੋਈ ਗੁਰਦੁਆਰਾ ਉੱਥੇ ਜਾਣਾ ਚਾਹੁੰਦੇ ਹੋ ਠੀਕ ਆ ਜੀ ਅਤੇ ਪਹਾੜਾਂ ਬਾਰੇ ਤੁਹਾਨੂੰ ਦੱਸੀ ਕਿ ਪਹਾੜਾਂ ਵੱਲ ਇੱਕ ਬਹੁਤ ਹੀ ਵਧੀਆ ਟੂਰ ਅਸੀਂ ਕੱਢਣ ਦੇ ਬਾਰੇ ਸੋਚ ਰਹੇ ਹਾਂ ਉਹ ਟੂਰ ਅਸੀਂ ਸ਼ਨੀਵਾਰ ਦੀ ਤੋਂ ਇੱਕ ਦਿਨ ਪਹਿਲਾਂ ਸ਼ੁਕਰਵਾਰ ਦੀ ਰਾਤ ਨੂੰ ਸ਼ਨੀਵਾਰ ਤੋਂ ਇੱਕ ਦਿਨ ਪਹਿਲਾਂ ਆਪਾਂ ਕੱਢਾਂਗੇ ਅਤੇ ਸ਼ਨੀਵਾਰ ਨੂੰ ਅਸੀਂ ਨਾ ਉੱਥੇ ਪਹੁੰਚੇ ਹੋਵਾਂਗੇ ਪਹਾੜਾਂ ਵਿੱਚ ਆਪਾਂ ਬਾਏ ਟਰੇਨ ਬਾਏ ਬੱਸ ਜਿਵੇਂ ਤੁਸੀਂ ਕਹੋਗੇ ਓਵੇਂ ਲੈ ਜਾਂਗੇ ਤੁਸੀਂ ਕਿਸ ਤਰ੍ਹਾਂ ਜਾਣਾ ਚਾਹੋਗੇ ਹਾਂਜੀ ਹਾਂ ਟਰੇਨ ਦਾ ਸਫ਼ਰ ਜ਼ਿਆਦਾ ਕੰਫਰਟੇਬਲ ਵੀ ਰਹੂਗਾ ਅਤੇ ਜ਼ਿਆਦਾ ਸਸਤਾ ਵੀ ਰਹੂਗਾ ਸੇਫ ਤਾਂ ਉਹ ਹੈ ਹੀ ਹੈ ਠੀਕ ਹੈ ਅਤੇ ਆਪਾਂ ਉੱਥੇ ਜਾ ਕੇ ਆਪਾਂ ਤੁਹਾਨੂੰ ਇੱਕ ਵਾਰ ਦੱਸਾਂ ਤੁਹਾਨੂੰ ਆਪਾਂ ਕੀ ਕੀ ਕਰ ਸਕਦੇ ਹਾਂ ਉੱਥੇ ਜਾ ਕੇ ਹਾਂਜੀ ਪੇਮੈਂਟ ਤਾਂ ਚਲੋ ਮੈਂ ਤੁਹਾਨੂੰ ਦੱਸੁੰਗਾ ਕਿਵੇਂ ਕਰਨੀ ਆ ਅਤੇ ਆਪਾਂ ਉੱਥੇ ਜਾ ਕੇ ਪਹਿਲਾਂ ਤਾਂ ਆਪਾਂ ਗੁਰਦੁਆਰੇ ਦੇ ਦਰਸ਼ਨ ਕਰਾਂਗੇ ਮਨੀਕਰਨ ਸਾਹਿਬ ਤਾਂ ਆਪਾਂ ਜ਼ਰੂਰ ਕਰਾਂਗੇ ਕਰਾਂਗੇ ਬਟ ਜੇ ਆਪਾਂ ਨੂੰ ਮੌਕਾ ਮਿਲਿਆ ਤਾਂ ਆਪਾਂ ਤਾਂ ਹੇਮਕੁੰਟ ਸਾਹਿਬ ਵਿੱਚ ਜ਼ਰੂਰ ਜਾ ਕੇ ਆਵਾਂਗੇ ਅਤੇ ਇਹ ਤਾਂ ਚਲੋ ਧਾਰਮਿਕ ਗੱਲਾਂ ਹੋ ਗਈਆਂ ਉਹ ਤੋਂ ਬਾਅਦ ਮੌਜ ਮਸਤੀ ਲਈ ਆਪਾਂ ਜਾ ਸਕਦੇ ਹਾਂ ਜਾ ਸਕਦੇ ਹਾਂ ਦੈਨ ਵੂਈ ਕੈਨ ਗੋ ਸਨੋਅ ਫਾਲਸ ਏਰੀਏ ਜਿੱਥੇ ਬਰਫ਼ ਪੈਂਦੀ ਹੋਵੇ ਬਰਫ਼ ਗਿਰਦੀ ਸਮਝ ਰਹੇ ਹੋ ਨਾ ਤੁਸੀਂ ਬਰਫ਼ ਗਿਰਦੀ ਆ ਅ ਪਰਿਵਾਰ 'ਚ ਬੱਚੇ ਹੋਣਗੇ ਬੱਚੇ ਨੂੰ ਖੁਸ਼ੀ ਹੁੰਦੇ ਨਾ ਬਰਫ ਦੇਖ ਕੇ ਅਤੇ ਉਹ ਵੀ ਕਾਫੀ ਮਜਾ ਆਉਂਦਾ ਵਾ ਤੁਸੀਂ ਉਹ ਤੋਂ ਬਾਅਦ ਹੈਲੀਕਾਪਟਰ ਵੀ ਹੁੰਦੇ ਨੇ ਪਹਾੜ ਚੜਨ ਵਾਸਤੇ ਘੋੜੇ ਸਵਾਰੀ ਦੈਨ ਹੋਰ ਵੀ ਬਹੁਤ ਕੁਛ ਕਰ ਸਕਦੇ ਹੋ ਤੁਹਾਨੂੰ ਮੈਂ ਕਿੰਨੇ ਚੀਜ਼ਾਂ ਤੁਸੀਂ ਕਰ ਸਕਦੇ ਹੋ ਤੁਸੀਂ ਏ ਏਰੀਆ ਘੁੰਮ ਸਕਦੇ ਹੋ ਰਾਫਟਿੰਗ ਕਰ ਸਕਦੇ ਹੋ ਰੀਵਰ ਰਾਫਟਿੰਗ ਕਰ ਸਕਦੇ ਹੋ ਨਹਿਰੀ ਪਾਣੀ 'ਚ ਤੁਸੀਂ ਕਿਸ਼ਤੀਆਂ ਚਲਾ ਸਕਦੇ ਹੋ

ਓਕੇ ਜੀ ਟੂਰ ਤੁਸੀਂ ਮਿਨੀਮਮ ਤੁਸੀਂ ਦੋ ਦਿਨ ਦਾ ਤਾਂ ਜਾਉਗਾ ਹੀ ਜਾਊਗਾ ਪਰ ਤੁਸੀਂ ਜੇ ਕਹੋਂਗੇ ਤਾਂ ਤਿੰਨ ਦਿਨ ਚਾਰ ਦਿਨ ਹਫ਼ਤਾ ਮਹੀਨਾ ਜਿਵੇਂ ਤੁਸੀਂ ਕਹੋਂਗੇ ਉਵੇਂ ਕਰ ਦਾਂਗੇ ਇੱਕ ਦਿਨ ਦਾ ਟੂਰ ਠੀਕ ਰਹੇਗਾ ਇੱਕ ਦਿਨ ਤਾਂ ਸਾਨੂੰ ਪਹੁੰਚਦੇ ਪਹੁੰਚਦੇ ਲੱਗ ਜਾਣੇ ਆ ਤਿੰਨ ਦਿਨ ਦਾ ਤਿੰਨ ਦਿਨ ਦਾ ਤਾਂ ਜੀ ਹਾਂਜੀ ਬਹੁਤ ਹੀ ਮਦਦ ਕਰ ਜਾਊਗਾ ਤੁਸੀਂ ਜਿਵੇਂ ਕਹੋਂਗੇ ਆਪਾਂ ਉਵੇਂ ਕਰ ਦਾਂਗੇ ਅਤੇ ਰਹੀ ਗੱਲ ਪੇਮੈਂਟ ਦੀ ਤਿੰਨ ਦਿਨ ਦਾ ਟੂਰ ਤੁਹਾਨੂੰ ਜੀ ਬਾਰਾਂ ਹਜ਼ਾਰ ਪੈ ਜੂਗਾ ਫਾਈਵ ਮੈਂਬਰਸ ਦੀ ਫੈਮਲੀ ਵਿਧ ਸਟੇਅ ਵਿਧ ਫੂਡ ਲੋਜਿੰਗ ਐਵਰੀਥਿੰਗ ਇਨਕਲੂਡ ਤੁਹਾਡਾ ਇਹ ਕਰ ਦੇਵਾਂ ਜੀ ਜੀ ਡਿਸਕਾਊਂਟ ਵਗੈਰਾ ਕੋਨ 'ਤੇ ਅਵੇਲੇਬਲ ਆਪਾਂ ਕਰਵਾ ਦਾਂਗੇ ਐਟ ਦਾ ਮੂਮੈਂਟ ਜੇ ਕੋਈ ਬਣਦਾ ਹੋਇਆ ਤਾਂ ਦੇਖ ਲਾਂਗੇ ਪਰ ਇੰਨਾ ਵੀ ਪੰਜ ਬੰਦੇ ਦੀ ਫੈਮਲੀ ਲਈ ਵੀ ਇਹ ਵੀ ਬਹੁਤ ਹੀ ਵਧੀਆ ਹੈ ਜੇ ਆਪਾਂ ਕਰੀਏ ਤਾਂ ਅਤੇ ਪੱਕਾ ਕਰਦਾ ਜੀ ਧੰਨਵਾਦ ਜੀ ਤੁਸੀਂ ਮਿਲੋ ਫਿਰ ਆ ਕੇ ਸਾਨੂੰ ਠੀਕ ਆ ਜੀ